ਹੈਲੋ ਕੀ ਤੁਸੀਂ ਹਰਮਨ ਟਰੈ ਟਰੈਵਲਰਸ ਏਜੰਸੀ ਤੋਂ ਬੋਲ ਰਹੇ ਹੋ ਮੈਂ ਨਿਊ ਅੰਮ੍ਰਿਤਸਰ ਤੋਂ ਬੋਲ ਰਹੀ ਹਾਂ ਕੱਲ੍ਹ ਮੈਂ ਇੱਕ ਟੈਕਸੀ ਤੁਹਾਡੇ ਥਰੂ ਬੁੱਕ ਕਰਵਾਈ ਸੀ ਅਤੇ ਉਹ ਟੈਕਸੀ ਨੂੰ ਟਾਈਮ ਦਿੱਤਾ ਸੀ ਛੇ ਵਜੇ ਆਉਣ ਦਾ ਲੇਕਿਨ ਅਸੀਂ ਸਾਰਾ ਪਰਿਵਾਰ ਤਿਆਰ ਹੋ ਕੇ ਬੈਠੇ ਹਾਂ ਚੰਡੀਗੜ੍ਹ ਜਾਣ ਵਾਸਤੇ ਤੇ ਹਾਲੇ ਤੱਕ ਟੈਕਸੀ ਆਈ ਨਹੀਂ ਅਸੀਂ ਦੁਬਾਰਾ ਉਹਨਾਂ ਨੂੰ ਪੁੱਛਿਆ ਫੋਨ ਕਰਕੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਆ ਰਿਹਾ ਹਾਂ ਮੈਂ ਗੋਲਡਨ ਗੇਟ ਤੱਕ ਆਵਾਂਗਾ ਉਸ ਤੋਂ ਅੱਗੇ ਤੁਸੀਂ ਆਪ ਆ ਜਾਉ ਜੇ ਅਸੀਂ ਆਪ ਹੀ ਅਸ ਉੱਥੇ ਜਾਣਾ ਹੈ ਹੋਰ ਕੋਈ ਵਹੀਕਲ ਲੈ ਕੇ ਤਾਂ ਫੇਰ ਸਾਨੂੰ ਉਹ ਕੈਬ ਕਰਨ ਦੀ ਕੀ ਜ਼ਰੂਰਤ ਸੀ ਸਾਡੇ ਕੋਲ ਸਮਾਨ ਵੀ ਕਾਫੀ ਹੈ ਛੋਟੇ ਛੋਟੇ ਬੱਚੇ ਵੀ ਹਨ ਇਸ ਕਰਕੇ ਕਾਫੀ ਮਨ ਨਿਰਾਸ਼ ਹੋਇਆ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਇਸ ਕੈਬ ਨੂੰ ਮੈਂ ਰੱਦ ਕਰਦੀ ਹਾਂ ਅਤੇ ਮੈਂ ਕੋਈ ਹੋਰ ਕੈਬ ਕਰ ਲਵਾਂਗੀ ਅਤੇ ਕਿਰਪਾ ਕਰਕੇ ਮਿਹਰਬਾਨੀ ਕਰਕੇ ਜੋ ਮੈਂ ਬੁਕਿੰਗ ਦੇ ਪੈਸੇ ਦਿੱਤੇ ਆ ਉਹ ਮੈਨੂੰ ਪੈਸੇ ਵਾਪਸ ਕੀਤੇ ਜਾਣ ਤਾਂ ਕਿ ਮੈਂ ਕੋਈ ਹੋਰ ਕੈਬ ਕਰਕੇ ਚਲੀ ਜਾਵਾਂ ਧੰਨਵਾਦ